ਬੱਚਿਆਂ ਵੱਲੋਂ ਮੁੱਖ ਤੌਰ 'ਤੇ ਇਨਡੋਰ ਅਤੇ ਆਊਟਡੋਰ ਖੇਡਾਂ ਵਿੱਚ ਭਾਗ ਲਿਆ ਜਾਂਦਾ ਹੈ ਜੇਕਰ ਆਊਟਡੋਰ ਖੇਡਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਸਭ ਤੋਂ ਵੱਡੇ ਪੱਧਰ 'ਤੇ ਖੇਡੀ ਜਾਣ ਵਾਲੀ ਖੇਡ ਕ੍ਰਿਕਟ ਦੀ ਹੈ ਕਿਉਂਕਿ ਇਸ ਵਿੱਚ ਕਾਫੀ ਗਲੈਮਰ ਅਤੇ ਪੈਸਾ ਹੋਣ ਵਜੋਂ ਇਹ ਖੇਡ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇ ਇਹ ਖੇਡ ਆਮ ਤੌਰ 'ਤੇ ਖਾਲੀ ਪਲਾਟਾਂ ਅਤੇ ਸਟੇਡੀਅਮ ਆਦਿ ਵਿੱਚ ਬੱਚਿਆਂ ਵੱਲੋਂ ਛੁੱਟੀ ਵਾਲੇ ਦਿਨ ਵੁ ਵਿੱਚ ਵੱਡੇ ਪੱਧਰ 'ਤੇ ਖੇਡੀ ਜਾਂਦੀ ਹੈ ਇਸ ਤੋਂ ਇਲਾਵਾ ਮਾਰਸ਼ਲ ਖੇਡਾਂ ਜੂਡੋ ਕਰਾਟੇ ਆਦਿ ਵਿੱਚ ਵੀ ਬੱਚਿਆਂ ਵੱਲੋਂ ਭਾਗ ਲਿਆ ਜਾਂਦਾ ਹੈ ਪਿੰਡਾਂ ਵਿੱਚ ਸ਼ਾਮ ਨੂੰ ਆਮ ਤੌਰ 'ਤੇ ਵਾਲੀਬਾਲ ਦੀ ਖੇਡ ਵੀ ਬੱਚਿਆਂ ਵਿੱਚ ਕਾਫੀ ਮਸ਼ਹੂਰ ਹੈ ਅਤੇ ਬੱਚਿਆਂ ਵੱਲੋਂ ਦੋ ਦੋ ਟੀਮਾਂ ਬਣਾ ਕੇ ਵਾਲੀਬਾਲ ਦੀ ਖੇਡ ਵਿੱਚ ਵੀ ਭਾਗ ਲਿਆ ਜਾਂਦਾ ਹੈ ਜੇਕਰ ਆਪਾਂ ਇਨਡੋਰ ਖੇਡਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਬੱਚਿਆਂ ਵੱਲੋਂ ਸਵਿਮਿੰਗ ਆਦਿ ਦੀ ਸਿਖਲਾਈ ਵੀ ਲਈ ਜਾਂਦੀ ਹੈ ਇਹਨਾਂ ਵਿੱਚ ਸ਼ਤਰੰਜ ਅਤੇ ਬੈਡਮਿੰਟਨ ਆਦਿ ਖੇਡਾਂ ਵਿੱਚ ਵੀ ਬੱਚਿਆਂ ਵੱਲੋਂ ਭਾਗ ਲਿਆ ਜਾਂਦਾ ਹੈ ਅਤੇ ਪੁਲਿਸ ਅਤੇ ਫੌਜ ਦੀ ਭਰਤੀ ਆਦਿ ਲਈ ਬੱਚਿਆਂ ਵੱਲੋਂ ਦੌੜ ਆਦਿ ਲਗਾਈ ਜਾਂਦੀ ਹੈ ਅਤੇ ਸਪੋਰਟਸ ਕੋਟੇ ਵਿੱਚ ਭਰਤੀ ਲਈ ਉਹਨਾਂ ਵੱਲੋਂ ਇਹਨਾਂ ਲੰਬੀ ਛਾਲ ਅਤੇ ਉੱਚੀ ਛਾਲ ਆਦਿ ਦੀ ਪ੍ਰੈਕਟਿਸ ਵੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਦੇਖਿਆ ਜਾਂਦਾ ਹੈ ਕਿ ਇਹ ਖੇਡ ਆਮ ਤੌਰ 'ਤੇ ਉ ਸਪੋਰਟਸ ਕੋਟੇ ਵਿੱਚ ਨੌਕਰੀਆਂ ਹੋਣ ਵਜੋਂ ਵੀ ਮੌਜੂਦਾ ਸਮੇਂ ਵਿੱਚ ਬੱਚਿਆਂ ਦਾ ਖੇਡਾਂ ਪ੍ਰਤੀ ਰੁਝਾਨ ਵਧਿਆ ਹੈ ਇਹ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਟੈਕਨੋਲਜੀ ਦੇ ਪ੍ਰਸਾਰ ਵਿੱਚ ਅਥਾਹ ਵਾਧੇ ਹੋਣ ਕਾਰਨ ਬੱਚਿਆਂ ਵੱਲੋਂ ਇਨਡੋਰ ਖੇਡਾਂ ਮੋਬਾਈਲਾਂ ਆਦਿ 'ਤੇ ਵੀ ਖੇਡੀਆਂ ਜਾਂਦੀਆਂ ਹਨ ਅਤੇ ਉਹ ਵੀਡੀਓ ਗੇਮਾਂ ਖੇਡਣ ਨੂੰ ਵੀ ਤਰਜੀਹ ਦਿੰਦੇ ਹਨ